ਸਾਡੇ ਪੰਜਾਬੀ ਕਲਚਰ ਤੋਂ ਇਲਾਵਾਂ ਮੈਂ ਸਾਊਥ ਫੂਡ ਵੀ ਬਣਾ ਚੁੱਕੀ ਹਾਂ ਜਿਸ ਵਿੱਚ ਮੈਂ ਡੋਸਾ ਬਣਾਇਆ ਸੀ ਡੋਸਾ ਜੋ ਕਿ ਸਿਹਤ ਲਈ ਕਾਫ਼ੀ ਹੱਦ ਤੱਕ ਸਿਹਤਮੰਦ ਹੈ ਉਸ ਵਿੱਚ ਕੋਈ ਵੀ ਉਹ ਪਦਾਰਥ ਸ਼ਾਮਿਲ ਨਹੀ ਹੁੰਦਾ ਜੋ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਾਏ ਇੱਕ ਤਰ੍ਹਾਂ ਇਸਨੂੰ ਸਿਹਤ ਲਈ ਵਧੀਆ ਪਦਾਰਥ ਮੰਨਿਆ ਜਾ ਸਕਦਾ ਹੈ ਅਤੇ ਕਾਫ਼ੀ ਹਲਕਾ ਫੁਲਕਾ ਨਾਸ਼ਤਾ ਦੌਰਾ ਦੌਰਾਨ ਵੀ ਸੁਣ ਲਿਆ ਜਾ ਸਕਦਾ ਹੈ ਇਹ ਸਾਊਥ ਵਿੱਚ ਕਾਫ਼ੀ ਮਸ਼ਹੂਰ ਹੈ ਪਰ ਇਹ ਇਸ ਦਾ ਆਨੰਦ ਹਰ ਇੱਕ ਕਲਚਰ ਦੇ ਲੋਕ ਲੈਂਦੇ ਹਨ ਇਹ ਕਾਫ਼ੀ ਤਰੀਕਿਆ ਨਾਲ ਬਣਾਇਆ ਜਾ ਸਕਦਾ ਹੈ ਜਿਵੇਂ ਕਿ ਕਈਆ ਨੂੰ ਮਸਾਲਾ ਡੋਸਾ ਪਸੰਦ ਹੁੰਦਾ ਕਈਆਂ ਨੂੰ ਪਨੀਰ ਡੋਸਾ ਅਤੇ ਹੋਰ ਵੀ ਕਈ ਤਰ੍ਹਾਂ ਦੇ ਡੋਸੇ ਅੱਜ ਦੇ ਸਮੇਂ ਵਿੱਚ ਪ੍ਰਸਿੱਧ ਹਨ ਪਰ ਮੈਂ ਕਿਸੇ ਦਿਨ ਮਸਾਲਾ ਡੋਸਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਅਤੇ ਮੈਂ ਉਸ ਨੂੰ ਬਣਾਇਆ ਜਿਸ ਉਸਨੂੰ ਆਪਣੇ ਤਰੀਕੇ ਨਾਲ ਬਣਾਉਣ ਦੀ ਕੋਸ਼ਿਸ਼ ਕੀਤੀ ਅਤੇ ਉਸ ਦੀ ਰੈਸਪੀ ਦੀ ਮੈਂ ਥੋੜ੍ਹੀ ਜਾਣਕਾਰੀ ਇੰਟਰਨੈਟ ਦੌਰਾ ਇੰਟਰਨੈਟ ਤੋਂ ਲਈ ਅਤੇ ਉਸ ਨੂੰ ਬਣਾਇਆ ਮੈਂ ਉਹ ਡੋਸਾ ਬਹੁਤ ਵਧੀਆ ਬਣਿਆ ਅਤੇ ਮੇਰੇ ਘਰ ਵਾਲ ਘਰਦਿਆਂ ਵੱਲੋਂ ਬਹੁਤ ਪਸੰਦ ਕੀਤਾ ਗਿਆ ਡੋਸਾ ਖਾਣ ਵਿੱਚ ਸਾਡੀ ਸਿਹਤ ਦਾ ਕੋਈ ਵੀ ਨੁਕਸਾਨ ਨਹੀਂ ਹੁੰਦਾ ਬਲਕਿ ਇਸ ਵਿੱਚ ਸਬਜ਼ੀਆਂ ਅਤੇ ਕੁਝ ਉਹ ਪਦਾਰਥ ਵ ਸ਼ਾਮਿਲ ਹੁੰਦੇ ਹਨ ਜੋ ਸਾਡੀ ਸਿਹਤ ਲਈ ਬਹੁਤ ਵਧੀਆ ਹਨ